ਰੇਲ ਗੱਡੀ ਦੀਆਂ ਸੀਟਾਂ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਹਨ ਇਹ ਬਹੁਤ ਆਰਾਮਦਾਇਕ ਹੁੰਦੀਆਂ ਹਨ ਇਹ ਮੂਲ ਦੇ ਅਧਾਰ 'ਤੇ ਹੁੰਦੀਆਂ ਹਨ ਰੇਲ ਗੱਡੀ 'ਤੇ ਇੱਕ ਬਰਥ ਇਕ ਬਿਸਤਰਾ ਹੁੰਦਾ ਹੈ ਆਮ ਤੌਰ 'ਤੇ ਬੰਕ ਬੈਂਚਾਂ ਵਾਂਗ ਸਟੈਕ ਦਾ ਕੀਤਾ ਜਾਂਦਾ ਹੈ ਜਿਸ ਦੀ ਵਰਤੋਂ ਯਾਤਰੀ ਰਾਤ ਭਰ ਦੀ ਰੇਲ ਗੱਡੀ ਵਿੱਚ ਸੌਣ ਲਈ ਕਰ ਸਕਦੇ ਹਨ ਰੇਲ ਗੱਡੀ 'ਤੇ ਵੱਖ ਵੱਖ ਤਰ੍ਹਾਂ ਦੀਆਂ ਬਰਥਾਂ ਹੁੰਦੀਆਂ ਹਨ ਜਿਵੇਂ ਉੱਪਰਲੀ ਉੱਪਰਲੀ ਬਰਥ ਵਿਚਕਾਰਲੀ ਬਰਥ ਹੇਠਲੀ ਬਰਥ ਸਾਈਡ ਬਰਥ ਰੇਲ ਦੀਆਂ ਪਹੀਆ ਇੱਕ ਕਿਸਮ ਦਾ ਪਹੀਆ ਹੁੰਦਾ ਹੈ ਜੋ ਵਿਸ਼ੇਸ਼ ਤੌਰ 'ਤੇ ਰੇਲਵੇ ਪਟੜੀਆਂ 'ਤੇ ਵਰਤਣ ਲਈ ਤਿਆਰ ਕੀਤਾ ਜਾਂਦਾ ਹੈ ਰੇਲ ਗੱਡੀ ਦੇ ਵੱਖ ਵੱਖ ਹਿੱਸਿਆਂ ਤੋਂ ਬਹੁਤ ਸਾਰੇ ਸ਼ੌਰ ਆਉਂਦੇ ਹਨ ਜਿਵੇਂ ਰੇਲ ਚੀਕਣਾ ਸੀਟਾਂ ਘੰਟੀਆਂ ਇੰਜਨ ਦਾ ਰੌਲਾ ਰੇਲ ਗੱਡੀ ਨੂੰ ਲੰਘਣ ਲਈ ਵੱਖ ਵੱਖ ਟਰੈਕਾਂ ਦੀ ਲੋੜ ਹੁੰਦੀ ਹੈ ਮੈਂ ਰੇਲ ਗੱਡੀ ਰਾਹੀਂ ਪੰਜਾਬ ਵਿੱਚ ਵੱਖ ਵੱਖ ਥਾਵਾਂ 'ਤੇ ਯਾਤਰਾਵਾਂ ਕੀਤੀਆਂ ਹਨ